ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਰ ਜੀ ਮੈਂ ਨਾ ਸਰ ਇੱਥੋਂ ਨਿਊਜ਼ ਤੋਂ ਬੋਲ ਰਿਹਾ ਸਰ ਮੈਨੂੰ ਨਾ ਇੱਥੇ ਤੁਸੀਂ ਦੱਸੋ ਤੁਹਾਡੇ ਇੱਥੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਡਿਵੈਲਪਮੈਂਟ ਦਾ ਕੀ ਡਿਵੈਲਪਮੈਂਟ ਕਿੰਨੀ ਹੋਈ ਹੈ ਕੀ ਹਿਸਾਬ ਹੋ ਗਿਆ ਇੱਥੇ ਸ਼ਹਿਰ 'ਚ ਕਿਸ ਤਰ੍ਹਾਂ ਚੱਲ ਰਿਹਾ ਡਿਵੈਲਪਮੈਂਟ ਦਾ ਸਿਸਟਮ ਹਮ ਹਮ ਹਾਂਜੀ ਸਰ ਅੱਛਾ ਸਰ ਅੱਛਾ ਅੱਛਾ ਜੀ ਹਾਂਜੀ ਹਾਂਜੀ ਹਾਂਜੀ ਸਰ ਹਾਂਜੀ ਹਾਂਜੀ ਅੱਛਾ ਜੀ

ਅੱਛ ਅੱਛਾ ਜੀ ਅੱਛਾ ਜੀ ਅੱਛਾ ਜੀ ਸਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਬਹੁਤ ਬਹੁਤ ਆਪਣਾ ਕੀਮਤੀ ਸਮਾਂ ਮੈਨੂੰ ਦਿੱਤਾ ਧੰਨਵਾਦ ਸਰ ਜੀ ਸਾਰੀ ਇਨਫੋਰਮੇਸ਼ਨ ਦੇਣ ਵਾਸਤੇ